ਸਿਲੰਡਰ ਨੂੰ ਸਿੱਧਾ ਖੜ੍ਹਾ ਕਰੋ ਇਸ ਤਰ੍ਹਾਂ ਕਿ ਇਸ ਤਰ੍ਹਾਂ ਦੀ ਜਗ੍ਹਾ 'ਤੇ ਰੱਖੋ ਕਿ ਜਿੱਥੇ ਥੋੜ੍ਹੀ ਜਿਹੀ ਹਵਾਦਾਰ ਜਗ੍ਹਾ ਹੋਵੇ ਜਿ ਬਿਜਲੀ ਵਾਲਾ ਚੁੱਲ੍ਹਾ ਨਜ਼ਦੀਕ ਨਹੀਂ ਹੋਣਾ ਚਾਹੀਦਾ ਨਾ ਹੀ ਕੋਈ ਲੈਂਪ ਨਜ਼ਦੀਕ ਹੋਣਾ ਚਾਹੀਦਾ ਹੈ ਬਟਨਾਂ ਨੂੰ ਬੰਦ ਕਰਕੇ ਰੱਖੋ ਅਗਰ ਬਟਨ ਖੁੱਲ੍ਹਾ ਹੈ ਤਾਂ ਸਿਲੰਡਰ ਨੂੰ ਓਨ ਨਾ ਕਰੋ